ਬੈਂਕਿੰਗ ਅਤੇ ਬੀਮਾ ਅੱਜ ਦੇ ਜੀਵਨ ਦੇ ਵਿੱਚ ਬਹੁਤ ਹੀ ਵੱਡਾ ਪ੍ਰਭਾਵ ਪਾਉਂਦੇ ਹਨ ਬੈਂਕਿੰਗ ਦੀਆਂ ਸਕੀਮਸ ਨਾਲ ਫੰਡਸ ਨਾਲ ਪੈਸੇ ਸੇਵਿੰਗ ਅਕਾਊਂਟਸ ਨਾਲ ਜਾਂ ਲੋਕਰ ਦੇ ਵਿੱਚ ਸੋਨਾ ਰੱਖਣ ਨਾਲ ਇਹਨਾਂ ਚੀਜ਼ਾਂ ਨਾਲ ਬਹੁਤ ਹੀ ਜ਼ਿਆਦਾ ਆਸਾਨੀ ਹੋ ਗਈ ਹੈ ਅਤੇ ਚੋਰੀ ਵੀ ਘਟ ਗਈ ਹੈ ਜਦ ਸਾਨੂੰ ਪਤਾ ਹੁੰਦਾ ਵੀ ਸਾਡਾ ਪੈਸਾ ਅਤੇ ਸਾਡਾ ਸੋਨਾ ਬੈਂਕ ਦੇ ਵਿੱਚ ਸੁਰਕਸ਼ਿਤ ਹੈ ਅਤੇ ਬੀਮਾ ਵੀ ਬਹੁਤ ਹੀ ਜ਼ਰੂਰੀ ਹੋ ਗਿਆ ਹੈ ਜਦੋਂ ਕਿ ਅਚਾਨਕ ਕੋਈ ਸਮੱਸਿਆ ਖੜ੍ਹੀ ਹੋ ਜਾਏ ਕਿਸੇ ਪਰਿਵਾਰ 'ਤੇ ਜਾਂ ਕੋਈ ਗੁਜ਼ਰ ਜਾਏ ਤਾਂ ਉਹਦਾ ਜੇ ਬੀਮਾ ਕੀਤਾ ਜਾਵੇ ਤਾਂ ਉਹਦੇ ਪਰਿਵਾਰ ਨੂੰ ਪਿੱਛੋਂ ਇਹ ਮੁਸੀਬਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਸੇ ਵੀ ਚੀਜ਼ ਦਾ ਪੈਸੇ ਨੂੰ ਲੈ ਕੇ ਬਹੁਤ ਹੀ ਪ੍ਰਕਾਰ ਦੇ ਬੀਮੇ ਹੁੰਦੇ ਹਨ ਜਿਵੇਂ ਕਿ ਜ਼ਿੰਦਗੀ ਦਾ ਬੀਮਾ ਅਤੇ ਹੈਲਥ ਦਾ ਬੀਮਾ ਹੈਲਥ ਦਾ ਬੀਮਾ ਵੀ ਬਹੁਤ ਹਾਂ ਬਹੁਤ ਫਾਇਦੇਮੰਦ ਹੁੰਦਾ ਹੈ ਜੇ ਕੋਈ ਬਿਮਾਰ ਹੋ ਜਾਏ ਤਾਂ ਉਹ ਹੋਸਪਿਟਲ 'ਚ ਜਾ ਕੇ ਉਹਦਾ ਬੀਮਾ ਕੀਤਾ ਹੋਵੇ